ਗੁਰਬਾਣੀ ਕਹਿੰਦੀ ਹੈ ਕਿ ਹੱਸਣਾ ਖੇਡਣਾ ਮਨ ਕਾ ਚਾਉ ਤਾਂ ਖੇਡਾਂ ਸਾਡੇ ਅੰਦਰ ਜੋ ਸਵੈ ਵਿਸ਼ਵਾਸ ਸਵੈ ਮਾਣ ਪੈਦਾ ਕਰਦੀਆਂ ਹਨ ਉਹਦਾ ਕੋਈ ਮੁੱਲ ਹੀ ਨਹੀਂ ਹੈ ਇੱਕ ਬੱਚਾ ਜਦੋਂ ਕਿਸੇ ਟੀਮ ਦੀ ਹਿੱਸਾ ਬਣ ਜਾਂਦਾ ਨਾ ਤਾਂ ਆਪਣੇ ਆਪ ਹੀ ਜਦੋਂ ਉਹਨੂੰ ਜਿੱਤਾਂ ਅਤੇ ਮਿਲਦੀਆਂ ਨੇ ਤਾਂ ਜਿੱਤਾਂ ਨਾਲ ਉਹਦਾ ਵਿਸ਼ਵਾਸ ਬਣਦਾ ਉਹਦਾ ਆਪਣੇ ਆਪ 'ਤੇ ਮਾਣ ਪੈਦਾ ਹੁੰਦਾ ਪਰ ਨਾਲ ਹੀ ਹਾਰਾਂ ਵੀ ਉਹਨੂੰ ਬਹੁਤ ਕੁਛ ਸਿਖਾਉਂਦੀਆਂ ਉਹਦੇ ਅੰਦਰ ਦੇ ਟਿਕਾ ਨੂੰ ਪੈਦਾ ਕਰਦੀਆਂ ਨੇ ਉਹਦੇ ਅੰਦਰ ਕੁਝ ਖੋਣ ਦੀ ਸਮਰੱਥਾ ਵੀ ਪੈਦਾ ਕਰ ਦਿੰਦੀਆਂ ਨੇ ਅਤੇ ਉਹਨੂੰ ਸਮਝ ਪੈਦਾ ਕਰ ਦਿੰਦੀਆਂ ਨੇ ਖੇਡਾਂ ਦੇ ਵਿੱਚ ਮਿਲ ਕੇ ਖੇਡਿਆ ਜਾਂਦਾ ਹੈ ਇੱਕ ਟੀਮ ਵਰਕ ਕੀਤਾ ਜਾਂਦਾ ਹੈ ਬਹੁਤ ਸਾਰੇ ਖਿਡਾਰੀ ਇਕੱਠੇ ਖੇਡਦੇ ਨੇ ਇੱਕ ਦੂਜੇ 'ਤੇ ਵੀ ਵਿਸ਼ਵਾਸ ਹੋ ਜਾਂਦਾ ਉਹਨਾਂ ਦਾ ਤਾਂ ਸਿਰਫ ਆਤਮ ਵਿਸ਼ਵਾਸ ਤਾਂ ਆਉਂਦਾ ਹੀ ਆਉਂਦਾ ਸਵੈ ਭਰੋਸਾ ਤਾਂ ਬੰਦੇ ਦੇ ਅੰਦਰ ਪੈਦਾ ਹੁੰਦਾ ਹੀ ਹੁੰਦਾ ਨਾਲ ਹੀ ਨਾਲ ਦੂਜਿਆਂ 'ਤੇ ਭਰੋਸਾ ਵੀ ਪੈਦਾ ਹੁੰਦਾ ਅਤੇ ਸਵੈਮਾਨਤਾ ਜਦੋਂ ਕੋਈ ਖਿਡਾਰੀ ਜਿੱਤ ਦਾ ਕੋਈ ਮੁਕਾਮ ਹਾਸਿਲ ਕਰਦਾ ਹੈ ਤਾਂ ਉਹਨੂੰ ਬੜਾ ਬੜਾ ਆਪਣੇ ਆਪ ਚ ਆਲੇ ਦੁਆਲੇ ਨੂੰ ਵੀ ਅਸੀਂ ਪ੍ਰਾਊਡ ਅਸੀਂ ਹਮੇਸ਼ਾਂ ਹੀ ਆਪਣੇ ਖਿਡਾਰੀਆਂ ਦੇ ਪ੍ਰਾਊਡ ਕਰਦੇ ਹਾਂ ਸਾਡੇ ਇਲਾਕੇ 'ਚੋਂ ਵੀ ਜੇ ਕੋਈ ਬੱਚਾ ਕੋਈ ਵਿਅਕਤੀ ਜਿੱਤ ਜੇ ਖੇਡ ਆਵੇ ਤਾਂ ਅਸੀਂ ਕਿਵੇਂ ਉਹਨੂੰ ਮਤਲਬ ਪਲਕਾਂ 'ਤੇ ਚੱਕ ਲੈਂਦੇ ਹਾਂ ਸਾਨੂੰ ਕਿੰਨਾ ਚੰਗਾ ਲੱਗਦਾ ਨਾ ਤਾਂ ਖੇਡਾਂ ਤਾਂ ਸਾਡੇ ਮਾਨਸਿਕ ਸਰੀਰਿਕ ਅੰਦਰੂਨੀ ਬਾਹਰੀ ਵਿਕਾਸ ਲਈ ਸਾਡੇ ਮਨ ਦੇ ਵਿਕਾਸ ਲਈ ਸਾਡੇ ਅੰਦਰ ਸਵੈ ਵਿਸ਼ਵਾਸ ਨੂੰ ਪੈਦਾ ਕਰਦੀਆਂ ਸਾਡੇ ਸਾਡੇ ਅੰਦਰ ਮਿਲਵਰਤਨ ਦੀ ਭਾਵਨਾ ਨੂੰ ਪੈਦਾ ਕਰਦੀਆਂ ਨੇ ਅਤੇ ਖੇਡਾਂ ਦਾ ਤਾਂ ਕੋਈ ਸਾਨੀ ਹੀ ਨਹੀਂ ਹੈਗਾ ਖੇਡਾਂ ਨੂੰ ਤਾਂ ਅਸੀਂ ਬਿਲਕੁਲ ਕਿਸੇ ਕਮਜ਼ੋਰ ਤੋਂ ਕਮਜ਼ੋਰ ਵਿਅਕਤੀ ਦੇ ਅੰਦਰ ਜਿਹੜਾ ਬਿਲਕੁਲ ਹੀ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਕਰਦਾ ਆਪਣਾ ਆਪ 'ਤੇ ਭਰੋਸਾ ਨਹੀਂ ਕਰਦਾ ਉਹਨੂੰ ਵੀ ਖੇਡਣ ਲਾ ਦਈਏ ਤਾਂ ਉਹਦੇ ਅੰਦਰ ਵੀ ਵਿਸ਼ਵਾਸ ਦੀ ਸ਼ਕਤੀ ਸਵੈ ਮਾਨ ਦੀ ਸ਼ਕਤੀ ਜਿਹੜੀ ਹੈ ਉਹ ਪੈਦਾ ਹੋ ਜਾਵੇਗੀ